ਪੰਜ ਹਜ਼ਾਰ ਚਾਰ ਸੌ ਤੀਹ ਤਿੰਨ ਹਜ਼ਾਰ ਪੰਜ ਸੌ ਪੰਜਾਹ ਨੌ ਹਜ਼ਾਰ ਤਿੰਨ ਸੌ ਤੀਹ ਸੱਠ ਲੱਖ ਚਾਲੀ ਹਜ਼ਾਰ ਛੇ ਸੌ ਪੰਦਰਾਂ ਦਸ ਲੱਖ ਬਾਹਠ ਹਜ਼ਾਰ ਨੌ ਸੌ ਪੱਚੀ